ਭਾਰਤ ਵਿੱਚ ਬਹੁਤ ਸਾਰੇ ਰਾਜ ਹਨ ਮਗਰ ਮੇਰਾ ਸਭ ਤੋਂ ਪਸੰਦੀਦਾ ਰਾਜ ਹੈ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਮੇਰਾ ਸਭ ਤੋਂ ਪਸੰਦੀਦਾ ਰਾਜ ਇਸ ਲਈ ਹੈ ਕਿਉਂਕਿ ਮੈਨੂੰ ਉੱਥੇ ਘੁੰਮਣ ਜਾਣ ਵਿੱਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਕਿਉਂਕਿ ਉਹ ਇੱਕ ਪਹਾੜੀ ਇਲਾਕਾ ਹੈ ਅਤੇ ਮੈਨੂੰ ਪਹਾੜ ਬਹੁਤ ਜ਼ਿਆਦਾ ਪਸੰਦ ਹਨ ਸਿਰਫ ਮੇਰਾ ਹੀ ਨਹੀਂ ਪਸੰਦੀਦਾ ਰਾਜ ਹੈ ਉਹ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਰਾਜ ਹੈ ਮੇਰੀ ਸਾਰੀ ਫੈਮਿਲੀ ਦਾ ਵੀ ਉਹ ਸਭ ਤੋਂ ਪਸੰਦੀਦਾ ਰਾਜ ਹੈ ਮੈਂ ਹਮੇਸ਼ਾ ਛੁੱਟੀਆਂ ਦੇ ਵਿੱਚ ਹਿਮਾਚਲ ਪ੍ਰਦੇਸ਼ ਘੁੰਮਣ ਜਾਂਦੀ ਹਾਂ ਉੱਥੇ ਮੈਨੂੰ ਘੁੰਮਣਾ ਬਹੁਤ ਜ਼ਿਆਦਾ ਪਸੰਦ ਹੈ ਉੱਥੇ ਜਾ ਕੇ ਮੈਂ ਬਹੁਤ ਜ਼ਿਆਦਾ ਮਜ਼ਾ ਕਰਦੀ ਹਾਂ ਇੰਜੋਏ ਕਰਦੀ ਹਾਂ ਆਪਣੇ ਦੋਸਤਾਂ ਨਾਲ ਜਾਂਦੀ ਹਾਂ ਆਪਣੀ ਘਰਦਿਆਂ ਨਾਲ ਜਾਂਦੀ ਹਾਂ ਉੱਥੇ ਜਾ ਕੇ ਮੈਨੂੰ ਮੈਗੀ ਖਾਣਾ ਤਾਂ ਬਹੁਤ ਹੀ ਪਸੰਦ ਹੈ ਕਿਉਂਕਿ ਪਹਾੜੀ ਇਲਾਕਾ ਮੈਨੂੰ ਇਸ ਕਰਕੇ ਬਹੁਤ ਪਸੰਦ ਹੈ ਕਿਉਂਕਿ ਮੈਂ ਨੇਚਰ ਦੇ ਨਾਲ ਕੁਦਰਤ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਅਤੇ ਉੱਥੇ ਇਹੋ ਜਿਹਾ ਮੌਸਮ ਦੇਖਣ ਵਿੱਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਜਦੋਂ ਉੱਥੇ ਮੈਂ ਜਾਂਦੀ ਹਾਂ ਤਾਂ ਮੈਂ ਉੱਥੇ ਜਾ ਕੇ ਮੈਗੀ ਤਾਂ ਜ਼ਰੂਰ ਖਾਂਦੀ ਹਾਂ ਕਿ ਉਹ ਨਾਲੇ ਉੱਥੇ ਜਾ ਕੇ ਮੈਂ ਵੀਡੀਓਜ ਬਣਾਉਂਦੀ ਹਾਂ ਬਹੁਤ ਜ਼ਿਆਦਾ ਟੂਰਿਸਟ ਵੀ ਉੱਥੇ ਆਉਂਦੇ ਹਨ ਇਸ ਕਰਕੇ ਹਿਮਾਚਲ ਪ੍ਰਦੇਸ਼ ਮੇਰਾ ਸਭ ਤੋਂ ਪਸੰਦੀਦਾ ਰਾਜ ਹੈ